ਜੇ ਆਪਾਂ ਟਰੈਕ ਦੀ ਗੱਲ ਕਰੀਏ ਤਾਂ ਟਰੈਕ ਪੂਰਾ ਹੋਣ ਦਾ ਅਹਿਸਾਸ ਦੀ ਗੱਲ ਕਰੀਏ ਟਰੈਕ ਪੂਰਾ ਹੋਣ ਦਾ ਅਹਿਸਾਸ ਬਹੁਤ ਹੀ ਵਧੀਆ ਸੀ ਕਿਉਂਕਿ ਟਰੈਕ ਅਸੀਂ ਸੁਬਾਹ ਨੌ ਵਜੇ ਸ਼ੁਰੂ ਕੀਤਾ ਅਤੇ ਸ਼ਾਮੀ ਪੰਜ ਵਜੇ ਦੇ ਕਰੀਬ ਅਸੀਂ ਖਤਮ ਕੀਤਾ ਤਾਂ ਪੰਜ ਵਜੇ ਟਰੈਕ ਪੂਰਾ ਹੋਣ ਤੋਂ ਬਾਅਦ ਜੋ ਅਹਿਸਾਸ ਸੀ ਬਹੁਤ ਹੀ ਜ਼ਿਆਦਾ ਵਧੀਆ ਸੀ ਹਾਂ ਟਰੈਕ ਦੇ ਦੌਰਾਨ ਵੀ ਜੋ ਅਸੀਂ ਬਹੁਤ ਵਧੀਆ ਮਹਿਸੂਸ ਕੀਤਾ ਕਿਉਂਕਿ ਜੋ ਉਸ ਦੇ ਦੌਰਾਨ ਸਾਨੂੰ ਦ੍ਰਿਸ਼ ਮਿਲੇ ਉਹ ਬਹੁਤ ਹੀ ਮਨਮੋਹਕ ਸੀ ਮੈਂ ਉਹਨਾਂ ਵਿੱਚੋਂ ਇੱਕ ਦ੍ਰਿਸ਼ ਦੀ ਜੇ ਗੱਲ ਕਰਾਂ ਤਾਂ ਉਸ ਦੇ ਰਸਤੇ ਵਿੱਚ ਸੀ ਸ਼ਿਵਾ ਕੈਫੇ ਜਿਸ ਦੇ ਸਾਈਡ 'ਤੇ ਝਰਨਾ ਵਹਿ ਰਿਹਾ ਸੀ ਸ਼ਿਵਾ ਕੈਫੇ ਦਾ ਜੋ ਝਰਨਾ ਸੀ ਉਹ ਬਹੁਤ ਹੀ ਮਨਮੋਹਕ ਸੀ ਅਸੀਂ ਉੱਥੇ ਇੱਕ ਤੋਂ ਦੋ ਘੰਟੇ ਬਤੀਤ ਕੀਤੇ ਅਸੀਂ ਮਨੋਰੰਜਨ ਕੀਤਾ ਉੱਥੇ ਆਪਣਾ ਲੰਚ ਝਰਨੇ ਦੇ ਕਿਨਾਰੇ 'ਤੇ ਬੈਠ ਕੇ ਕੀਤਾ ਜੋ ਕਿ ਸਾਡੇ ਲਈ ਇੱਕ ਯਾਦ ਬਣ ਕੇ ਰਹਿ ਗਿਆ ਪਰ ਉਹ ਜੋ ਸਾਡੀ ਯਾਦ ਸੀ ਉਹ ਨਾ ਭੁੱਲਣ ਵਾਲੀ ਯਾਦ ਸੀ ਜੋ ਮੇਰਾ ਟਰੈਕ ਸੀ ਉਸ ਟਰੈਕਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਦ੍ਰਿਸ਼ ਸਨ ਪਰ ਮੇਰਾ ਸਭ ਤੋਂ ਮਨਮੋਹਕ ਦ੍ਰਿਸ਼ ਉਹ ਮੇਰਾ ਸ਼ਿਵਾ ਕੈਫੇ ਵਾਲਾ ਜੋ ਝਰਨਾ ਸੀ ਉਹ ਸੀ ਉੱਥੇ ਸਭ ਕੁਛ ਬਾਕੀ ਸ਼ਾਂਤ ਸੀ ਸਿਰਫ ਝਰਨੇ ਦੇ ਪਾਣੀ ਦੀ ਆਵਾਜ਼ ਸੀ ਜੋ ਕਿ ਮਨ ਨੂੰ ਮੋਹਣ ਵਾਲੀ ਸੀ ਸਾਰੇ ਲੋਕ ਹੀ ਉੱਥੇ ਰੁਕ ਕੇ ਇੱਕ ਘੰਟਾ ਜਾਂ ਦੋ ਘੰਟੇ ਆਪਣੇ ਬਤੀਤ ਕਰਕੇ ਫੇਰ ਅੱਗੇ ਦਾ ਟਰੈਕ ਕਰਦੇ ਸੀ ਕਿਉਂਕਿ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਉਹ ਦ੍ਰਿਸ਼ ਬਹੁਤ ਪਸੰਦ ਆ ਰਿਹਾ ਸੀਗਾ ਇਸ ਲਈ ਮੇਰਾ ਸਭ ਤੋਂ ਮਨਮੋਹਕ ਦ੍ਰਿਸ਼ ਸ਼ਿਵਾ ਕੈਫੇ ਝਰਨਾ ਸੀ ਧੰਨਵਾਦ